ਸਕੂਲਾਂ ਵਿੱਚ ਹਰ ਇੱਕ ਤਰ੍ਹਾਂ ਦੇ ਵਿਸ਼ੇ ਜਿਹੜੇ ਆ ਪੜ੍ਹਾਏ ਜਾਂਦੇ ਆ ਅਤੇ ਇਹਨਾਂ ਵਿਸ਼ਿਆਂ ਦੀ ਵੰਡ ਜਿਹੜੀ ਹੈ ਉਹ ਕਲਾਸਾਂ ਦੇ ਅਕੋਰਡਿੰਗ ਕੀਤੀ ਹੁੰਦੀ ਹੈ ਜਿਸ ਤਰ੍ਹਾਂ ਛੋਟੀਆਂ ਕਲਾਸਾਂ ਨੂੰ ਜਿਹੜੇ ਉਹ ਮੇਨ ਮੇਨ ਸਬਜੈਕਟਸ ਰਖਵਾਏ ਜਾਂਦੇ ਜਿੱਦਾਂ ਪੰਜਾਬੀ ਹੋ ਗਿਆ ਹਿੰਦੀ ਇੰਗਲਿਸ਼ ਮੈਥ ਮਤਲਬ ਉਨ੍ਹਾਂ 'ਤੇ ਇੰਨਾ ਬੋਝ ਨਹੀਂ ਪਾਇਆ ਜਾਂਦਾ ਡਰਾਇੰਗ ਜਿਹੜਾ ਉਨ੍ਹਾਂ ਨੂੰ ਐਂਟਰਟੇਨ ਕਰਨ ਲਈ ਆਰਟ ਐਂਡ ਕ੍ਰਾਫਟ ਵਗੈਰਾ ਵਰਗੇ ਸਬਜੈਕਟ ਜਾਂ ਫਿਰ ਇਸ ਤਰ੍ਹਾਂ ਹੀ ਖਿਡਾਉਣ ਵਾਲੇ ਮਤਲਬ ਪਲੇਅ ਨਾਲ ਰਿਲੇਟਡ ਜਿਹੜੇ ਸਬਜੈਕਟ ਉਹ ਤਰ੍ਹਾਂ ਹੀ ਮਤਲਬ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਸੋ ਜਿਸ ਤਰ੍ਹਾਂ ਕਲਾਸਿਜ਼ ਅੱਗੇ ਜਾਂਦੀਆਂ ਰਹਿੰਦੀਆਂ ਅਤੇ ਉਸ ਤੋਂ ਬਾਅਦ ਜਿਹੜੇ ਆ ਉਹ ਸਟਰੀਮਸ ਬਦਲ ਜਾਂਦੀਆਂ ਹੈ ਕਿ ਅਲੱਗ ਅਲੱਗ ਜਿਵੇਂ ਕਮਰਸ ਆਰਟਸ ਨੋਨ ਮੈਡੀਕਲ ਮੈਡੀਕਲ ਉਨ੍ਹਾਂ ਦੇ ਅਲੱਗ ਅਲੱਗ ਜਿਹੜੇ ਆ ਵਿਸ਼ੇ ਹੁੰਦੇ ਆ ਜਿੱਦਾਂ ਮੈਡੀਕਲ ਦੇ ਵਿੱਚ ਬਾਕੀ ਅਤੇ ਸਾਰੇ ਨੋਨ ਮੈਡੀਕਲ ਵਾਲੇ ਜਿੱਦਾਂ ਫਿਜਿਕਸ ਕਮਿਸਟਰੀ ਬਾਇਓ ਇਹ ਵਾਲੇ ਸਭ ਮੇਨ ਸਬਜੈਕਟ ਹੁੰਦੇ ਆ ਅਤੇ ਜਿਹੜਾ ਹੈਗਾ ਨੋਨ ਮੈਡੀਕਲ ਉਹਦੇ ਵਿੱਚ ਫਿਜਿਕਸ ਕਮਿਸਟਰੀ ਅਤੇ ਆਪਣੇ ਕੋਲ ਮੈਥਮੈਟਿਕਸ ਹੁੰਦਾ ਹੈ ਕਮਰਸ ਦੇ ਵਿੱਚ ਅਕਾਊਂਟਸ ਹੁੰਦਾ ਹੈ ਹੋਰ ਵੀ ਕਾਫੀ ਟਾਈਪ ਦੇ ਜਿਹੜੇ ਉਨ੍ਹਾਂ ਦੇ ਉਨ੍ਹਾਂ ਦੇ ਨਾਲ ਸਟਰੀਮ ਦੇ ਨਾਲ ਰਿਲੇਟਡ ਜਿਹੜੇ ਉਹ ਵਿਸ਼ੇ ਹੁੰਦੇ ਆ ਇਸ ਤਰ੍ਹਾਂ ਆਰਟਸ ਦੇ ਵਿੱਚ ਵੀ ਹਿਸਟਰੀ ਜੋਗਰਾਫੀ ਟਾਈਪ ਜਿਹੜੇ ਉਨ੍ਹਾਂ ਦੇ ਵਿਸ਼ੇ ਹੁੰਦੇ ਆ ਸੋ ਜਿਹੜੇ ਟੀਚਰਸ ਆ ਅਧਿਆਪਕ ਉਹ ਬਹੁਤ ਹੀ ਵਧੀਆ ਪੜ੍ਹਾਉਂਦੇ ਆ ਉਹ ਬੱਚਿਆਂ ਦੇ ਮਾਇੰਡ ਜਿਸ ਤਰ੍ਹਾਂ ਸੈੱਟ ਹੁੰਦਾ ਉਸ ਤਰੀਕੇ ਨਾਲ ਹੀ ਚੀਜ਼ਾਂ ਨੂੰ ਜਿਹੜਾ ਵਾ ਉਹ ਮੋਲਡ ਕਰਕੇ ਜਾਂ ਮੋਡੀਫਾਈ ਕਰਕੇ ਉਸ ਤਰ੍ਹਾਂ ਹੀ ਬੱਚੇ ਨੂੰ ਸਮਝਾਉਂਦੇ ਆ ਅਗਰ ਛੋਟਾ ਬੱਚਾ ਹੈ ਤਾਂ ਉਹਨੂੰ ਇੱਕ ਗੇਮ ਦੀ ਤਰ੍ਹਾਂ ਜਿਹੜਾ ਵਾ ਉਹਨੂੰ ਰਿਪ੍ਰੇਜ਼ੈਂਟ ਕਰ ਦਿੰਦੇ ਉਸ ਕਵਸ਼ਚਨ ਉਸ ਆਂਸਰ ਨੂੰ ਤਾਂ ਕਿ ਬੱਚੇ ਨੂੰ ਈਜ਼ੀਲੀ ਸਮਝ ਲੱਗ ਜੇ ਅਗਰ ਬੱਚੇ ਵੱਡੇ ਆ ਅਤੇ ਅਗਰ ਜਿਸ ਤਰ੍ਹਾਂ ਉਸਨੂੰ ਸਮਝ ਲੱਗਦਾ ਉਹਨੂੰ ਉਸ ਤਰੀਕੇ ਨਾਲ ਕਰਵਾਉਂਦੇ ਆ ਟੀਚਰਸ ਜਿਹੜੇ ਉਹ ਬਹੁਤ ਹੀ ਪੜ੍ਹੇ ਲਿਖੇ ਬਹੁਤ ਹੀ ਚੰਗੇ ਆ ਜਿਹੜੇ ਕਿ ਬੱਚਿਆਂ ਦੇ ਹਿਸਾਬ ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਜਿਹੜੇ ਸਬਜੈਕਟ ਉਹ ਰਿਵਾਈਜ਼ ਕਰਵਾਉਂਦੇ ਆ ਅਤੇ ਇਸ ਤਰ੍ਹਾਂ ਜਿਹੜੇ ਬੱਚੇ ਆ ਉਹ ਵਧੀਆ ਵਧੀਆ ਅੱਗੇ ਪੜ੍ਹ ਪਾਉਂਦੇ ਆ